ਸਤਿ ਸ਼੍ਰੀ ਅਕਾਲ ਪੰਜਾਬੀ ਭਾਸ਼ਾ ਸਾਡੀ ਬਾਕੀ ਰਾਜ ਦੀਆਂ ਖੇਤਰੀ ਉਪਭਾਸ਼ਾ ਤੋਂ ਕਿਵੇਂ ਵੱਖਰੀ ਹੈ ਜੀ ਵੈਸੇ ਪੰਜਾਬੀ ਭਾਸ਼ਾ ਬਹੁਤ ਹੀ ਸੋਹਣੀ ਭਾਸ਼ਾ ਹੈ ਆਪਣੀ ਆਪਣੀ ਵਿਸ਼ੇਸ਼ਯ ਅਤੇ ਸੁੰਦਰਤਾ ਦੇ ਮੁਕਾਬਲੇ ਸਾਰੀ ਭਾਸ਼ਾਏ ਵਧੀਆ ਹੈ ਪਰ ਪੰਜਾਬੀ ਭਾਸ਼ਾ ਦੀ ਵਿਆਕਰਨ ਲੇਖਣ ਵਿਗਿਆਨ ਅਤੇ ਅਲੱਗ ਉਚਾਰਨ ਦੇ ਕਾਰਨ ਪੰਜਾਬੀ ਭਾਸ਼ਾ ਨੂੰ ਅਲੱਗ ਬਣਾਇਆ ਜਾਂਦਾ ਹੈ ਇਹ ਭਾਸ਼ਾ ਆਪਣੇ ਸਮਰਿਧ ਵਿਰਾਸਤ ਲੋਕ ਸਾਹਿਤਿਆ ਅਤੇ ਵਿਚਾਰੋ ਦੀ ਬਾਗਡੋਰ ਹੈ ਜੋ ਉਸਨੂੰ ਵੱਖਰੀ ਅਤੇ ਖੂਬਸੂਰਤ ਬਣਾਉਂਦਾ ਹੈ ਹਰ ਭਾਸ਼ਾ ਆਪਣੀ ਇੱਕ ਸੁੰਦਰ ਪਹਿਚਾਣ ਲਈ ਮੁਖਾਵਤ ਆ ਜਿੱਦਾਂ ਸਾਡੀ ਪੰਜਾਬੀ ਭਾਸ਼ਾ ਉਹਦਾ ਇੱਕ ਆਪਣਾ ਇੱਕ ਖੂਬਸੂਰਤ ਇਤਿਹਾਸ ਹੈ ਸਾਡੇ ਬਾਬਾ ਜੀ ਸਾਡੇ ਪੂਰਵਜ ਜਿੰਨੇ ਵੀ ਬਾਬਾ ਜੀ ਜਿਨ੍ਹਾਂ ਨੇ ਬਲੀਦਾਨ ਦਿੱਤਾ ਆਪਣੇ ਗੁਰੂ ਸਾਹਿਬ ਜੀ ਨੇ ਆਪਣੇ ਬੱਚਿਆਂ ਦਾ ਬਲੀਦਾਨ ਦੇ ਤਾ ਤਿਆਗ ਦੇ ਤਾ ਇਹ ਭਾਸ਼ਾ ਸਾਨੂੰ ਉਹਨਾਂ ਦੀ ਇੱਕ ਵਿਰਾਸਤ ਦੇ ਤੌਰ 'ਤੇ ਮਿਲੀ ਹੋਈ ਆ ਪੰਜਾਬੀ ਦੀ ਲੋਕ ਕਲਾ ਅਤੇ ਵਿਰਾਸਤ ਵਿੱਚ ਪੰਜਾਬੀ ਭਾਸ਼ਾ ਦਾ ਵਰਤਮਾਨ ਆ ਅਤੇ ਇਹ ਭਾਸ਼ਾ ਆਪਣੀ ਆਪਣੀ ਮਹਿਕਮਾ 'ਚ ਆਪਣੇ ਆਪਣੇ ਰੰਗ ਵਿੱਚ ਚਮਕਦੀ ਆ ਜਦੋਂ ਪੰਜਾਬੀ ਬੋਲਦੇ ਹੈ ਤਾਂ ਇੱਕ ਬਹੁਤ ਸਨਮਾਨ ਅਤੇ ਪਿਆਰ ਅਤੇ ਬਹੁਤ ਸਮਰਿਧ ਖੂਬਸੂਰਤ ਇਤਿਹਾਸ ਅਤੇ ਉਤਸਾਹਨ ਮਿਲਦਾ ਹੈ ਅਤੇ ਇਸ ਕਾਰਨ ਅਸੀਂ ਕਹਾਂਗੇ ਪੰਜਾਬੀ ਭਾਸ਼ਾ ਬਹੁਤ ਹੀ ਪਿਆਰੀ ਭਾਸ਼ਾ ਹੁੰਦੀ ਆ ਜੋ ਸਿੱਖਣ 'ਚ ਵੀ ਬਹੁਤ ਆਸਾਨ ਹੁੰਦੀ ਆ ਧੰਨਵਾਦ ਜੀ